ਹਾ ਇੱਕ ਪੰਛੀ ਅਜੀਆ ਹੈ ਕਿ ਜਿਹੜਾ ਮੈਨੂੰ ਸਭ ਤੋਂ ਅਲੱਗ ਹੀ ਲੱਗਦਾ ਹੈ ਉਹ ਇੱਕ ਕਾਂ ਹੈ

ਜਾਂ ਕੋਈ ਰੋਟੀ ਪਾਨੀ ਆ ਉਹ ਬੜਾ ਖੁਸ਼ ਹੋ ਕੇ ਅੱਧੀ ਅੱਗੇ ਆਉਂਦਾ ਤੇ ਚੁੱਕ ਕੇ ਲੈ ਜਾਂਦਾ ਹੈ ਜਿਹੜੀ ਚੀਜ਼ ਨੂੰ ਪਸੰਦ ਨਹੀਂ ਹੁੰਦੀ ਉਸ ਵੱਲ ਤੱਕਦਾ ਵੀ ਨਹੀਂ ਪਰ ਜਦੋਂ ਮੈਂ ਪਨੀਰ ਡਾਲਦੀ ਹਾਂ ਪਨੀਰ ਪਾਂਦੀ ਹਾਂ ਤਾ ਉਹ ਮਿੰਟਾਂ ਚ ਲੈ ਜਾਂਦਾ ਹੈ ਉਸਦੇ ਬਜਾਏ ਅਗਰ ਉਹਨੂੰ ਮੈਂ ਕੋਈ ਸਿੰਪ ਸਾਦੀ ਰੋਟੀ ਦੇ ਦਵਾਂ ਉਹ ਤਾਂ ਉਹਨੇ ਹੀ ਖਾਂਦਾ ਲੇਕਿਨ ਜਦੋਂ ਉਹਨੂੰ ਮੈਂ ਕੋਈ ਲੱਡੂ ਦਵਾਂ ਕੋਈ ਮਿਠਾਈ ਦਵਾਂ ਜਾਂ ਕੋਈ ਪਨੀਰ ਦਵਾਂ ਉਹ ਦੋ ਮਿੰਟਾਂ ਚ ਖਾ ਲੈਂਦਾ ਹੈ ਜਾ ਕੋਈ ਪੋੜੀ ਤੋ ਕੋਈ ਹਲਵਾ ਦੋ ਉਹ ਬਹੁਤ ਖੁਸ਼ ਹੋ ਕੇ ਖਾਦਾ ਹੈ ਲੱਤ ਉਸਦੀ ਇੱਕ ਹੈ ਪਰ ਉੱਠਦਾ ਭੱਜਦਾ ਬਾਕੀ ਕਾਵਾਂ ਤੋਂ ਵੀ ਜਿਆਦਾ ਹੈ ਜਦ ਸਾਰੇ ਕੰਮ ਆਉਂਦੇ ਹਨ ਉਹ ਉਹਨਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਹੀ ਚੀਜ਼ ਚੁੱਕਦਾ ਹੈ ਮੈਂ ਤਾਂ ਉਹਨੂੰ ਵੇਖ ਕੇ ਹੈਰਾਨ ਹੀ ਹੋ ਜਾਨੀ ਆ ਕਿ ਦੇਖ ਲਓ ਪਰਮਾਤਮਾ ਨੇ ਇਹਦੇ ਚ ਕੀ ਜਗਹਾ ਕਮੀ ਪਾਈ ਲੇਕਿਨ ਹੋਰ ਕਈ ਚੀਜ਼ਾਂ ਹਨ ਜਿਸ ਵਿੱਚ ਪੂਰਨ ਤਰਾ ਸਫਲ ਹੈ ਆਪਣੇ ਬਰਾਬਰ ਕਾਵਾਂ ਤੋਂ ਅੱਗੇ ਵਧ ਕੇ ਖਾਂਦਾ ਹੈ ਦੇਖ ਲਓ ਰੱਬ ਜੇਕਰ ਸਾਨੂੰ ਕਿਸੇ ਪਾਸੇ ਇੱਕ ਪਾਸੇ ਕਮੀ ਪਾਦਾਂ ਹੈ ਤੇ ਉਸਦੀ ਪੂਰਤੀ ਦੂਸਰੇ ਪਾਸੇ ਬਹੁਤ ਵਧੀਆ ਨਾਲ ਦਿੰਦਾ ਹੈ ਉਹ ਇੱਕ ਅਵੱਲਾ ਜਿਹਾ ਕਾਂ ਹੈ ਜਿਹੜਾ ਮੈਨੂੰ ਰੋਜ਼ ਦਿਖਦਾ ਹੈ ਮੈਨੂੰ ਰੋਜ਼ ਯਾਦ ਆਉਂਦਾ ਹੈ ਮੈਨੂੰ ਅੱਜ ਵੀ ਚੰਗਾ ਲੱਗਦਾ ਹੈ